ਮੈਂ ਅੰਸ਼ੁਲ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੁਝ ਦਿਨ ਪਹਿਲਾਂ ਮੈਂ ਤੁਹਾਡੀ ਕੰਪਨੀ ਤੋਂ ਇੱਕ ਔਨਲਾਈਨ ਪੱਖਾ ਔਡਰ ਕੀਤਾ ਸੀ ਅਤੇ ਮੈਂ ਉਸ ਦੇ ਸੰਬੰਧ ਵਿੱਚ ਤੁਹਾਨੂੰ ਦੱਸ ਰਿਹਾ ਕਿ ਕੁਝ ਟਾਈਮ ਪਹਿਲਾਂ ਮੇਰੇ ਕੋਲ ਉਹ ਔਡਰ ਪਹੁੰਚਿਆ ਅਤੇ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਉਹ ਔਡਰ ਮੈਨੂੰ ਟਾਈਮ ਤੋਂ ਪਹਿਲਾਂ ਵੀ ਪਹੁੰਚਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਜਦੋਂ ਮੈਂ ਉਸ ਦੀ ਪੈਕਜਿੰਗ ਦੇਖੀ ਉਸ ਦੀ ਪੈਕਜਿੰਗ ਬਹੁਤ ਹੀ ਸਹੀ ਢੰਗ ਨਾਲ ਕੀਤੀ ਗਈ ਸੀ ਅਤੇ ਉਸ ਦੇ ਉੱਪਰ ਬਿੱਲ ਵੀ ਬਹੁਤ ਸਹੀ ਤਰੀਕੇ ਨਾਲ ਚਿਪਕਾਇਆ ਹੋਇਆ ਸੀ ਬਿਲਕੁਲ ਇੱਕ ਇੱਕ ਡਿਟੇਲ ਦਿੱਤੀ ਹੋਈ ਸੀ ਅਤੇ ਉਸ ਤੋਂ ਬਾਅਦ ਜਦੋਂ ਮੈਂ ਉਸ ਪੈਕਜਿੰਗ ਨੂੰ ਖੋਲ੍ਹਿਆ ਤਾਂ ਸਭ ਤੋਂ ਪਹਿਲਾਂ ਮੈਨੂੰ ਉਸ ਵਿੱਚੋਂ ਇੱਕ ਬੁੱਕਲੈਟ ਲੱਭੀ ਇਸ ਬੁੱਕਲੈਟ ਵਿੱਚ ਦੱਸਿਆ ਹੋਇਆ ਸੀ ਕਿ ਇਸ ਪੱਖੇ ਨੂੰ ਕਿਵੇਂ ਇਸਤੇਮਾਲ ਕਰਨਾ ਜਾਂ ਕਿਵੇਂ ਜੋੜਨਾ ਉਸ ਵਿੱਚ ਪੱਖੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਸੀ ਅਤੇ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਉਸ ਬੁੱਕਲੈਟ ਵਿੱਚ ਪੰਜਾਬੀ ਭਾਸ਼ਾ ਦਾ ਵੀ ਇਸਤੇਮਾਲ ਕੀਤਾ ਗਿਆ ਸੀ ਜੋ ਮੇਰੇ ਲਈ ਪੜ੍ਹਨਾ ਬਹੁਤ ਆਸਾਨ ਸੀ ਅਤੇ ਜਦੋਂ ਮੈਂ ਉਸ ਪੱਖੇ ਦੀ ਪੈਕਜਿੰਗ ਖੋਲ੍ਹੀ ਅਤੇ ਉਸ ਪੱਖੇ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਹੁਤ ਆਰਾਮ ਨਾਲ ਜੁੜ ਗਿਆ ਕਿਉਂਕਿ ਉਸ ਬੁੱਕਲੈਟ ਵਿੱਚ ਸਾਰੀ ਇੰਸਟਰਕਸ਼ਨਾਂ ਸਭ ਕੁਛ ਦੱਸਿਆ ਹੋਇਆ ਸੀ ਅਤੇ ਉਸ ਤੋਂ ਬਾਅਦ ਜਦੋਂ ਪੱਖਾ ਪੂਰਾ ਸੈੱਟ ਹੋ ਗਿਆ ਤਾਂ ਉਸ ਦਾ ਰੰਗ ਬਹੁਤ ਵਧੀਆ ਸੀ ਉਸ ਤੋਂ ਇਲਾਵਾ ਉਹ ਪੱਖੇ ਦਾ ਡਿਜ਼ਾਇਨ ਬਹੁਤ ਵਧੀਆ ਸੀ ਅਤੇ ਜਦੋਂ ਉਸ ਨੂੰ ਮੈਂ ਸਾਰਾ ਜੋੜ ਕੇ ਸੈੱਟ ਕਰ ਲਿਆ ਅਤੇ ਉਸ ਨੂੰ ਚਲਾਇਆ ਤਾਂ ਉਹ ਬਹੁਤ ਵਧੀਆ ਤਰੀਕੇ ਨਾਲ ਚਲਿਆ ਅਤੇ ਉਸ ਤੋਂ ਬਹੁਤ ਠੰਡੀ ਹਵਾ ਆ ਰਹੀ ਸੀ ਅਤੇ ਇਸ ਦੇ ਨਾਲ ਮੈਂ ਇਹ ਗੱਲ ਨੋਟ ਕੀਤੀ ਕਿ ਉਹ ਪੱਖਾ ਬਾਕੀਆਂ ਪੱਖਿਆਂ ਨਾਲੋਂ ਵੱਖਰਾ ਸੀ ਕਿਉਂਕਿ ਇੱਕ ਤਾਂ ਉਹ ਲਾਈਟ ਵੇਟ ਸੀ ਅਤੇ ਜਿਸ ਦੇ ਨਾਲ ਉਸ ਦੀ ਸਪੀਡ ਬਾਕੀਆਂ ਪੱਖਿਆਂ ਨਾਲੋਂ ਤੇਜ਼ ਸੀ ਅਤੇ ਉਹ ਪੱਖਾ ਦੂਰੋਂ ਦੇਖ ਕੇ ਹੀ ਮਤਲਬ ਵ ਬਹੁਤ ਵਧੀਆ ਲੱਗ ਰਿਹਾ ਸੀ ਕਿ ਜਿਵੇਂ ਉਸ ਦਾ ਰੰਗ ਬਹੁਤ ਵਧੀਆ ਸੀ ਅਤੇ ਉਸ ਦੇ ਜੋ ਨਟ ਸੀ ਉਹ ਬਹੁਤ ਵਧੀਆ ਤਰੀਕੇ ਨਾਲ ਬਣਾਏ ਗਏ ਸੀ ਕਿ ਜਿਸ ਨਾਲ ਉਸ ਦਾ ਹਰ ਇੱਕ ਹਰ ਇੱਕ ਪੁਰਜਾ ਬਹੁਤ ਵਧੀਆ ਤਰ ਢੰਗ ਦੇ ਨਾਲ ਕੰਮ ਕਰ ਰਿਹਾ ਸੀ ਅਤੇ ਅੰਤ ਵਿੱਚ ਮੈਂ ਇਹੀ ਦੱਸਣਾ ਚਾਹਾਂਗਾ ਕਿ ਮੈਨੂੰ ਤੁਹਾਡਾ ਪੱਖਾ ਬਹੁਤ ਪਸੰਦ ਆਇਆ ਅਤੇ ਬਾਕੀ ਤੁਹਾਡਾ ਹਰ ਇੱਕ ਸਰਵਿਸ ਜਿਵੇਂ ਕਿ ਤੁਹਾਡੀ ਡਿਵਲ ਡਿਲੀਵਰੀ ਸਰਵਿਸ ਅਤੇ ਪੈਕਜਿੰਗ ਸਰਵਿਸ ਅਤੇ ਨਾਲ ਹੀ ਸਪੈਸ਼ਲ ਇੱਕ ਵਾਰੀ ਫਿਰ ਤੋਂ ਦੱਸ ਦੇਵਾਂ ਕਿ ਤੁਹਾਡਾ ਪੱਖਾ ਬਹੁਤ ਵਧੀਆ ਸੀ ਅਤੇ ਉਹ ਬਹੁਤ ਠੰਡੀ ਹਵਾ ਦੇ ਰਿਹਾ ਅਤੇ ਬਹੁਤ ਜਿਵੇਂ ਕਿ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਇੱਕ ਗੱਲ ਮੈਨੂੰ ਹੋਰ ਵਧੀਆ ਲੱਗੀ ਕਿ ਇਸਦੀ ਵਰੰਟੀ ਬਹੁਤ ਅ ਜ਼ਿਆਦਾ ਦਿੱਤੀ ਗਈ ਹੈ ਵਰੰਟੀ ਮਤਲਬ ਇਸ ਦੀ ਬਹੁਤ ਜ਼ਿਆਦਾ ਸਮੇਂ ਵਾਸਤੇ ਮੈਨੂੰ ਦਿੱਤੀ ਗਈ ਹੈ ਅਤੇ ਮੈਨੂੰ ਉਸ ਦੇ ਨਾਲ ਵਾਰੰਟੀ ਕਾਰਡ ਵੀ ਮਿਲਿਆ ਅਤੇ ਅੰਤ ਵਿੱਚ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਤੁਸੀਂ ਇੰਨਾ ਵਧੀਆ ਪੱਖਾ ਦਿੱਤਾ ਧੰਨਵਾਦ